ਜੇਕਰ ਮੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਕੋਵਿਡ ਨਾਈਟੀ ਦੇ ਲੱਛਣਾਂ ਦਾ ਅਨੁਭਵ ਕਰੇਗਾ ਤਾਂ ਮੈਂ ਨਜ਼ਦੀਕੀ ਹਸਪਤਾਲ ਵਿੱਚ ਜਾ ਕੇ ਕੋਵਿਡ ਨਾਈਟੀਨ ਦੇ ਟੈਸਟਿੰਗ ਅਤੇ ਟੀਕਾਕਰਨ ਕੇਂਦਰਾਂ ਬਾਰੇ ਜਾਣਕਾਰੀ ਲਵਾਂਗੀ ਨੇੜੇ ਟੈਸਟਿੰਗ ਅਤੇ ਟੀਕਾ ਕੇਂਦਰਾਂ ਦਾ ਪਤਾ ਲਗਾਉਣ ਲਈ ਸਰਕਾਰ ਨੇ ਤੇਈ ਸਤਾਨਵੇਂ ਅੱਸੀ ਛਿਆਲ਼ੀ ਹੈਲਪ ਲਾਈਨ ਨੰਬਰ ਦਿੱਤਾ ਹੈ ਉਸ ਦੀ ਵਰਤੋਂ ਕਰਕੇ ਮੈਂ ਲੋੜ ਅਨੁਸਾਰ ਕੋਵਿਡ ਨਾਈਟੀ ਟੈਸਟਾਂ ਅਤੇ ਟੀਕਾਕਰਨ ਲਾਗਤਾਂ ਨੂੰ ਸਹਾਇਤਾ ਪ੍ਰਦਾਨ ਕਰਾਂਗੀ ਅਤੇ ਉਹਨਾਂ ਨੂੰ ਦੱਸਾਂਗੀ ਕਿ ਕੋਵਿਡ ਨਾਈਟੀ ਤੋਂ ਬਚਣ ਲਈ ਸਾਨੂੰ ਕੀ ਕੀ ਕਰਨਾ ਚਾਹੀਦਾ ਹੈ ਹੈਲਪਲਾਈਨ ਨੰਬਰ ਤੇਈ ਸਤਾਨਵੇਂ ਅੱਸੀ ਛਿਆਲ਼ੀ ਤੋਂ ਸਾਨੂੰ ਟੀਕਾਕਰਨ ਦੀ ਮੁਲਾਕਾਤ ਇਹ ਦੱਸਣਗੇ ਕਿ ਕੋਵਿਡ ਨਾਈਟੀ ਦੇ ਲੱਛਣ ਕੀ ਹੁੰਦੇ ਹਨ ਅਤੇ ਸਾਨੂੰ ਕਿਹੜੀ ਕਿਹੜੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਇਸ ਤਰ੍ਹਾਂ ਮੈਂ ਕੋਵਿਡ ਨਾਈਟੀ ਟੈਸਟਾਂ ਅਤੇ ਟੀਕਾਕਰਨ ਮੁਲਾਕਾਤਾਂ ਨੂੰ ਨਿਰਧਾਰਨ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਾਂਗੀ